ਮੇਰਾ ਮਨਪਸੰਦ ਭੋਜਨ ਮਨਚੂਰੀਅਨ ਹੈ ਜੋ ਕਿਉਂਕਿ ਇਹ ਹੈਲਥੀ ਵੀ ਹੈ ਖਾਣ ਲਈ ਅਤੇ ਟੇਸਟ ਅਨੁਸਾਰ ਵਧੀਆ ਵੀ ਲੱਗਦਾ ਹੈ ਜਿਸ ਨੂੰ ਬਣਾਉਣ ਲਈ ਚਾਹੀਦਾ ਹੈ ਸਾਨੂੰ ਮਟਰ ਬੰਦ ਗੋਭੀ ਫੁੱਲ ਗੋਭੀ ਸ਼ਿਮਲਾ ਮਿਰਚ ਗਾਜਰ ਫਲੀਆਂ ਜੋ ਕਿ ਪੋਸ਼ਟਿਕ ਅਧਾ ਅਹਾਰ ਵੀ ਹੈ ਸਾਡੀ ਸਿਹਤ ਲਈ ਵੀ ਅੱਛਾ ਹੈ ਇਸ ਨੂੰ ਬਣਾਉਣ ਲਈ ਸਾਨੂੰ ਇਹ ਸਭ ਚੀਜ਼ਾਂ ਨੂੰ ਪਹਿਲਾਂ ਕ੍ਰਸ਼ ਕਰ ਲੈਣਾ ਹੈ ਕਸ਼ ਕਰਨ ਤੋਂ ਬਾਅਦ ਇਸਦੇ ਵਿੱਚ ਮੈਦਾ ਅਤੇ ਅਰਾਰੋਟ ਪਾ ਕੇ ਇਹਦੇ ਬਾਊਲ ਬਣਾ ਲੈਣੇ ਹਨ ਗੋਲ ਗੋਲ ਉਸ ਤੋਂ ਬਾਅਦ ਇਹਨਾਂ ਨੂੰ ਤੇਲ ਗਰਮ ਦੇ ਵਿੱਚ ਫਰਾਈ ਕਰ ਲੈਣਾ ਹੈ ਅੱਛੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਇਹਨਾਂ ਦਾ ਜਦੋਂ ਅੱਛਾ ਬਰਾਊਨ ਕਲਰ ਆ ਜਾਏ ਉਸ ਤੋਂ ਬਾਅਦ ਉਹਨਾਂ ਨੂੰ ਨਿਕਾਲ ਕੇ ਇਸ ਦੀ ਗ੍ਰੇਵੀ ਤਿਆਰ ਕਰਨੀ ਹੈ ਗ੍ਰੇਵੀ ਤਿਆਰ ਕਰਨ ਲਈ ਵੀ ਸਾਨੂੰ ਕੜਾਹੀ ਦੇ ਵਿੱਚ ਸੋਇਆ ਸੋਸ ਗ੍ਰੀਨ ਸੋਸ ਟਮਾਟੋ ਸੋਸ ਤੇਲ ਆਦਿ ਦੀ ਵਰਤੋਂ ਕਰਕੇ ਇਸਨੂੰ ਤੜਕਾ ਲਗਾਉਣਾ ਹੈ ਤੜਕਾ ਲਗਾਉਣ ਨਮਕ ਮਿਰਚ ਸਾਰਾ ਕੁਛ ਮਸਾਲਾ ਡਾਲ ਕੇ ਉਸ ਤੋਂ ਬਾਅਦ ਉਹਦੇ ਵਿੱਚ ਥੋੜ੍ਹਾ ਪਾਣੀ ਐਡ ਕਰਨਾ ਹੈ ਆਪਣੀ ਗ੍ਰੇਵੀ ਦੇ ਅਨੁਸਾਰ ਜਿੰਨੀ ਤੁਹਾਨੂੰ ਗ੍ਰੇਵੀ ਚਾਹੀਦੀ ਹੈ ਉਸ ਤੋਂ ਬਾਅਦ ਉਹਨੂੰ ਰਿੱਝਣੇ ਧਰ ਦਿਓ ਥੋੜ੍ਹੀ ਦੇਰ ਦਸ ਤੋਂ ਪੰਦਰਾਂ ਮਿੰਟ ਉਹਨੂੰ ਰਿੱਝਣ ਵਾਸਤੇ ਦਿਓ ਜਦੋਂ ਅੱਛੀ ਤਰ੍ਹਾਂ ਸਾਰੀਆਂ ਸਬਜ਼ੀਆਂ ਪੱਕ ਜਾਣ 'ਤੇ ਉਹਦੇ ਵਿੱਚ ਜਿਹੜੇ ਹੈ ਬੋਲ ਮਨਚੂਰੀਅਨ ਦੇ ਬਣਾਏ ਉਹ ਵਿੱਚ ਉਹਦੇ ਡਿੱਪ ਕਰ ਦਿਉ ਡਿੱਪ ਕਰਨ ਤੋਂ ਬਾਅਦ ਉੱਪਰੋਂ ਦੀ ਧਨੀਆ ਪਾ ਕੇ ਅਤੇ ਤੁਸੀਂ ਥੋੜ੍ਹੀ ਦੇਰ ਲਈ ਢੱਕ ਦਿਉ ਢੱਕਣ ਤੋਂ ਬਾਅਦ ਉਹਨੂੰ ਤੁਸੀਂ ਆਪਣੀ ਪਲੇਟ ਵਿੱਚ ਸਰਵ ਕਰਕੇ ਆਨੰਦਮਈ ਭੋਜਨ ਤਿਆਰ ਹੈ ਤੁਹਾਡਾ